ਪੰਜਾਬ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਸ ਵਿੱਚ ਹਾਕੀ ਕ੍ਰਿਕਟ ਕਬੱਡੀ ਕੁਸ਼ਤੀਆਂ ਖਿੱਦੋਂ ਖੁੰਡੀ ਆਦਿ ਵਰਗੀਆਂ ਪਰੰਪਰਾਗਤ ਖੇਡਾਂ ਸ਼ਾਮਿਲ ਹਨ ਖੇਡਾਂ 'ਤੇ ਸੱਟ ਸੱਟਾਂ ਦਾ ਸਬੰਧ ਦਾਮਨ ਚੋਲੀ ਵਰਗਾ ਹੁੰਦਾ ਹੈ ਭਾਵ ਗਰਾਊਂਡ ਵਿੱਚ ਖੇਡਦੇ ਸਮੇਂ ਸੱਟ ਲੱਗਣਾ ਆਮ ਹੀ ਹੈ ਖੇਡਾਂ ਦੌਰਾਨ ਖਿਡਾਰੀਆਂ ਨੂੰ ਸੱਟਾਂ ਤੋਂ ਬਚਾਉਣ ਲਈ ਕਈ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਵੇਂ ਉਸ ਦੇ ਲਈ ਫਰਸ਼ 'ਤੇ ਮੈਟ ਜਾਂ ਗੱਦੇ ਵਿਛਾਏ ਜਾਂਦੇ ਹਨ ਅਤੇ ਸਰੀਰਕ ਕਸਰਤਾਂ ਰਾਹੀਂ ਖਿਡਾਰੀਆਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ 'ਤੇ ਛੋਟੀਆਂ ਮੋਟੀਆਂ ਸੱਟਾਂ ਦਾ ਜ਼ਿਆਦਾ ਪ੍ਰਭਾਵ ਨਾ ਪਵੇ ਜਿਵੇਂ ਕੁਝ ਤਰ੍ਹਾਂ ਦੀ ਕਸਰਤਾਂ ਸਟਰੈਚਿਜ ਆਦਿ ਕਰਵਾਈ ਜਾਂਦੀ ਹੈ ਪਰ ਜੇਕਰ ਕਿਸੇ ਖਿਡਾਰੀ ਦੇ ਸੱਟ ਲੱਗ ਵੀ ਜਾਂਦੀ ਹੈ ਤਾਂ ਖਿਡਾਰੀ ਨੂੰ ਪਹਿਲਾਂ ਫਸਟ ਏਡ ਦਿੱਤੀ ਜਾਂਦੀ ਹੈ ਜੇਕਰ ਸੱਟ ਗੰਭੀਰ ਹੋਵੇ ਤਾਂ ਐਂਬੂਲੈਂਸ ਦੀ ਮਦਦ ਨਾਲ ਖਿਡਾਰੀ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਸਾਰਾ ਖਰਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕੀਤਾ ਜਾਂਦਾ ਹੈ